ਖੇਡਾਂ ਵਿੱਚ ਨਸਲੀ ਸਮੂਹ ਅਤੇ ਔਰਤਾਂ ਦੀ ਨੁਮਾਇੰਦਗੀ ਵੀ ਮਾੜੀ ਹੈ ਇਸ ਦੇ ਵਿੱਚ ਮੇਰੇ ਇਹ ਵਿਚਾਰ ਹਨ ਕਿ ਨਸਲੀ ਰੂਪ ਦੇ ਵਿੱਚ ਖੇਡਾਂ ਦਾ ਕੋਈ ਰੋਲ ਨਹੀਂ ਹੈਗਾ ਖੇਡਾਂ ਵਾਸਤੇ ਹਮੇਸ਼ਾ ਹੀ ਅੱਛੇ ਖਿਡਾਰੀ ਦੀ ਲੋੜ ਹੁੰਦੀ ਹੈ ਅਤੇ ਉਹ ਕਿਸੇ ਵੀ ਨਸਲ ਦਾ ਹੋ ਸਕਦਾ ਹੈ ਖੇਡ ਨੂੰ ਪ੍ਰੋਪਰ ਖੇਡਣ ਵਾਸਤੇ ਅਤੇ ਉਹਦੇ ਜਿਹੜੇ ਕਹਿ ਲਓ ਕਿ ਰੂਲਸ ਰੈਗੂਲੇਸ਼ਨ ਨੇ ਉਹਨੂੰ ਫੋਲੋ ਕਰਦੇ ਹੋਏ ਜਿਹੜੇ ਖਿਡਾਰੀ ਖੇਡਦੇ ਨੇ ਹਮੇਸ਼ਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਨ ਅਤੇ ਇੱਦਾਂ ਦੀ ਕੋਈ ਮਾੜੀ ਗੱਲ ਨਹੀਂ ਕਿ ਬੰਦਾ ਕਿਹੜੀ ਨਸਲ ਤੋਂ ਬਿਲੋਂਗ ਕਰਦਾ ਹੈ ਮੇਨਲੀ ਉਹਦੀ ਗੇਮ ਕਿਹੜੀ ਹੈ ਕਿਹੜੀ ਖੇਡ ਹੈ ਉਸ 'ਤੇ ਫੋਕਸ ਕਰੇ ਅਤੇ ਉਸ ਖੇਡ ਨੂੰ ਖੇਡਿਆ ਕਰੇ ਅਤੇ ਦੂਜੀ ਗੱਲ ਆਪਾਂ ਦੇਖੀਏ ਕਿ ਔਰਤਾਂ ਦੀ ਨੁਮਾਇੰਦਗੀ ਜੇ ਮੰਨ ਲਓ ਹੁਣ ਦੇਸ਼ ਹੀ ਪੂਰਾ ਬਦਲ ਚੁੱਕਾ ਹੈ ਪੂਰੀ ਦੁਨੀਆਂ ਵਿੱਚ ਔਰਤਾਂ ਮਤਲਬ ਵੱਧ ਚੜ ਕੇ ਹਿੱਸਾ ਲੈ ਰਹੀਆ ਅਤੇ ਖੇਡਾਂ ਵਿੱਚ ਉਹ ਕਿਵੇਂ ਪਿੱਛੇ ਹੋ ਸਕਦੀਆਂ ਵਾ ਅਤੇ ਇਹ ਜਿਹੜਾ ਤੁੱਕ ਨੇ ਸਹੀ ਹੰਡ ਸੌ ਪਰ ਸੌ ਪਰਸੈਂਟ ਹੀ ਗਲਤ ਹੈ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਵਾ ਕਿਉਂਕਿ ਖੇਡਾਂ ਵਿੱਚ ਨਸਲੀ ਸਮੂਹ ਦਾ ਜਿਹੜਾ ਹੈ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਖੇਡਾਂ ਨੂੰ ਆਪਾਂ ਖੇਡ ਦੇ ਭਾਵ ਨਾਲ ਨਹੀਂ ਸਮਝਾਂਗੇ ਨਹੀਂ ਖੇਡਾਂਗੇ ਉਦੋਂ ਤੱਕ ਆਪਾਂ ਜਾਤੀ ਪਾਤ ਦੇ ਵਿੱਚ ਵੰਡੇ ਰਵਾਂਗੇ ਅਤੇ ਉਹਦਾ ਸਾਨੂੰ ਨਾ ਚੰਗਾ ਰਿਜਲਟ ਮਿਲੇਗਾ ਨਾ ਅਸੀਂ ਚੰਗੇ ਖਿਡਾਰੀ ਪੈਦਾ ਕਰ ਸਕਦੇ ਹਾਂ ਅਤੇ ਨਾ ਅਸੀਂ ਚੰਗੇ ਲੈਵਲ 'ਚ ਜਾ ਕੇ ਚੰਗੇ ਮੈਡਲ ਲਾ ਸਕਦੇ ਹਾਂ